ਹੈਲੋ ਹਾਂਜੀ ਮੇਰਾ ਨਾਮ ਪਰਮਿੰਦਰ ਹੈ ਅਤੇ ਮੈਂ ਜਿਹੜਾ ਪਹਿਲੀ ਵਾਰ ਇੱਕ ਐਮਾਜ਼ੋਨ ਤੋਂ ਪ੍ਰੋਡਕਟ ਮੰਗਵਾਇਆ ਸੀ ਜਿਹਦਾ ਨਾਮ ਸੀਗਾ ਕਬਰਡ ਔਰਗਨਾਈਜਰ ਉਹ ਇਹਦੇ ਉਹਦੇ ਵਿੱਚ ਮੈਂ ਇੱਕ ਛੇ ਪ੍ਰਕਾਰ ਦੇ ਡੱਬੇ ਮੰਗਵਾਏ ਸੀ ਡੱਬੇ ਵੀ ਨਹੀਂ ਇਨ ਕੇਸ ਕਹਿ ਲਓ ਕਿ ਤੁਸੀਂ ਉਹ ਇੱਕ ਰੈਕਸ ਸੀਗੇ ਜਿਹਦੇ ਵਿੱਚ ਆਪਾਂ ਅਸੀਂ ਆਪਣੇ ਜਿਹੜੇ ਕੱਪੜੇ ਹੈਗੇ ਆ ਉਹ ਪ੍ਰੋਪਰਲੀ ਔਰਗਨਾਈਜ ਜਾਂ ਤਹਿ ਲਗਾ ਕੇ ਉਹਨਾਂ ਨੂੰ ਇੱਕ ਅੱਛੇ ਤਰੀਕੇ ਨਾਲ ਰੱਖ ਸਕਦੇ ਹਾਂ ਅਤੇ ਉਹਦੇ ਵਿੱਚ ਤਿੰਨ ਇੱਕ ਰੈਕ ਸੀਗੇ ਅਤੇ ਉਹ ਅਤੇ ਤਿੰਨ ਸੀਗੇ ਜਿੰਨ੍ਹਾਂ ਦੇ ਵਿੱਚ ਇਹ ਸੈਕਸ਼ਨਜ਼ ਬਣੇ ਸੀਗੇ ਹੈ ਨਾ ਕਿ ਉਹਦੇ ਵਿੱਚ ਆਪਾਂ ਵੱਖਰੇ ਵੱਖਰੇ ਤਰ੍ਹਾਂ ਦੀਆਂ ਟੀ ਸ਼ਰਟਸ ਜਾਂ ਜੀਨਸ ਵਗੈਰਾ ਜਿਹੜੀਆਂ ਹੈਗੀਆਂ ਉਹ ਅਰੇਂਜ ਕਰਕੇ ਰੱਖ ਸਕਦੇ ਹਾਂ ਅਤੇ ਇਸ ਦੇ ਨਾਲ ਉਹ ਮੈਨੂੰ ਪ੍ਰੋਡਕਟ ਜਿਹੜਾ ਮੇਰੇ ਲਈ ਮੇਰੀ ਅਲਮੀਰਾ ਲਈ ਬਹੁਤ ਯੂਜਫੁੱਲ ਰਿਹਾ ਕਿਉਕਿ ਹੁਣ ਜਿਵੇਂ ਪਹਿਲਾਂ ਬਹੁਤ ਖਿਲਾਰਾ ਪੈਂਦਾ ਸੀਗਾ ਮੇਰੀ ਅਲਮਾਰੀ ਦੇ ਵਿੱਚ ਠੀਕ ਹੈ ਹੁਣ ਉਹ ਜਿਹੜਾ ਹੈਗਾ ਖਿਲਾਰਾ ਬਹੁਤ ਘੱਟ ਦਿੱਸਦਾ ਹੈਗਾ ਤੇ ਵੀ ਜਿਹੜੇ ਕੱਪੜੇ ਹੈਗੇ ਆ ਉਹ ਪੂਰੀ ਤਰ੍ਹਾਂ ਚਿਣੇ ਹੁੰਦੇ ਹਨ ਕਿ ਤਾਂ ਕਿ ਸਾਨੂੰ ਜੋ ਲੱਭਣ ਦੇ ਵਿੱਚ ਹੈਗੇ ਜੋ ਵੀ ਅਸੀਂ ਕੱਪੜਾ ਪਾਉਣਾ ਚਾਹੁੰਦੇ ਹਾਂ ਉਹ ਲੱਭਣ ਦੇ ਵਿੱਚ ਮੈਨੂੰ ਹੁਣ ਬਹੁਤ ਆਸਾਨੀ ਹੁੰਦੀ ਹੈ ਅਤੇ ਇਸ ਕਰਕੇ ਜਿਹੜਾ ਹੈਗਾ ਉਹ ਇਹ ਪ੍ਰੋਡਕਟ ਜਿਹੜਾ ਮੇਰੇ ਲਈ ਬਹੁਤ ਯੂਜਫੁੱਲ ਰਿਹਾ ਹੈ ਹੈਗਾ ਅਤੇ ਮੈਂ ਤਾਂ ਐਡਵਾਈਸ ਕਰਾਂਗੀ ਕਿ ਸ਼ਾਇਦ ਹੋ ਸਕਦਾ ਇਨ ਫਿਊਚਰ ਵੀ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਮੈਂ ਇਸ ਪ੍ਰੋਡਕਟ ਨੂੰ ਜ਼ਿਆਦਾ ਮਤਲਬ ਇਕ ਵਾਰ ਫਿਰ ਪਰਚੇਜ ਕਰਾਂ ਅਤੇ ਇਟ ਇਜ ਵੈਰੀ ਯੂਜਫੁੱਲ ਫੋਰ ਮੀ